ਛੇ ਦੋ ਪੰਜ ਅੱਠ ਚਾਰ ਅੱਠ ਤਿੰਨ ਪੰਜ ਜੀਰੋ ਜੀਰੋ ਜੀਰੋ ਅੱਠ ਇੱਕ ਜੀਰੋ ਜੀਰੋ ਜੀਰੋ ਪੰਜ ਪੰਜ ਜੀਰੋ ਜੀਰੋ ਜੀਰੋ